ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਂ ਮੈਮ ਪ੍ਰਭਦੀਪ ਸਿੰਘ ਬੋਲਣ ਡਿਆ ਹਾਜੀ ਹਾਂਜੀ ਮੈਮ ਮੈਂ ਇੱਥੇ ਨਵਾਂ ਆਇਆ ਜੀ ਅਤੇ ਅਤੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਕੋਈ ਦੱਸ ਦਿਉ ਮੈਮ ਮੈਮ ਮੈਂ ਦੋਸਤ ਤੋਂ ਲਿਆ ਮੈਮ ਮੈਂ ਇੱਥੇ ਨਵਾਂ ਆਇਆ ਜੀ ਉਰੇ ਅਤੇ ਮੈਮ ਦੱਸੋ ਕੋਈ ਕਿਹੜੀ ਰਹਿਣ ਵਾਲੀ ਜਗ੍ਹਾ ਮੈਮ ਮਿਲ ਜੇਗੀ

ਠੀਕ ਮੈਮ ਹਾਂਜੀ ਮੈਮ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਖਾਣ ਪੀਣ ਵਾਲੀ ਜਗ੍ਹਾ ਮੈਮ ਕੋਈ

ਮੈਮ ਅੰਮ੍ਰਿਤਸਰ ਤੋਂ ਬਾਹਰ ਮੈਮ ਮੈਮ ਅੰਮ੍ਰਿਤਸਰ ਤੋਂ ਬਾਹਰ ਚਲੋ ਓਕੇ ਠੀਕ ਹੈ ਮੈਮ ਥੈਂਕ ਯੂ ਮੈਮ